ਹੈਲੋ ਸਰ ਮੈਂ ਗੁਰਦਾਸਪੁਰ ਤੋਂ ਜਗਦੀਸ਼ ਕੁਮਾਰੀ ਬੋਲ ਰਹੀ ਹਾਂ ਮੈਂ ਅੱਜ ਕੱਲ੍ਹ ਦੇ ਨਵੇਂ ਡਿਜ਼ਾਇਨ ਦੇ ਸੂਟ ਸਿੱਖਣਾ ਚਾਹੁੰਦੀ ਹਾਂ ਸਲਵਾਰ ਸੂਟ ਤਾਂ ਮੈਂ ਖੁਦ ਵੀ ਬਣਾ ਬਣਾ ਲੈਂਦੀ ਹਾਂ ਪਰ ਅੱਜ ਕੱਲ੍ਹ ਦੇ ਅਫਗਾਨੀ ਸੂਟ ਸਿੱਪੀ ਸਿਤਾਰੇ ਜੋ ਕਿ ਮੈਨੂੰ ਨਹੀਂ ਪਤਾ ਲੱਗਦਾ ਉਹ ਮੈਂ ਸਾਰਾ ਕੁਝ ਸਿੱਖਣਾ ਚਾਹੁੰਦੀ ਹਾਂ ਲੈਸ ਵਰਕ ਸਾਰਾ ਕੁਛ ਬੁਟੀਕ ਬੁਟੀਕ ਵਾਲੇ ਸੂਟ ਵੀ ਉਹ ਵੀ ਮੈਂ ਸਾਰਾ ਕੁਝ ਸਿੱਖਣਾ ਚਾਹੁੰਦੀ ਹਾਂ ਅਫਗਾਨੀ ਸਲਵਾਰ ਸਰਾਰਾ ਸੂਟ ਲਹਿੰਗਾ ਚੋਲੀ ਇਹ ਸਾਰਾ ਕੁਛ ਮੈਂ ਸਿੱਖਣਾ ਚਾਹੁੰਦੀ ਹਾਂ ਅਤੇ ਉਹਨਾਂ ਲਈ ਮੈਨੂੰ ਵੀ ਉਹਨਾਂ ਕਰਕੇ ਮੈਂ ਉਹ ਸਾਰਾ ਕੁਝ ਯੂਟੀਊਬ 'ਤੇ ਦੇਖਦੀ ਪਈ ਹਾਂ ਕਿ ਮੈਨੂੰ ਸਾਰਾ ਕੁਛ ਉੱਥੋਂ ਪਤਾ ਲੱਗ ਜਾਏ ਇਸ ਕਰਕੇ ਮੈਂ ਮੈਨੂੰ ਥੋੜ੍ਹੀ ਜਿਹੀ ਨੌਲੇਜ ਹੋਈ ਆ ਉਹਨੂੰ ਬਾਰੇ ਪੀ ਕਿੱਦਾਂ ਕਟਿੰਗ ਕਰੀਦੀ ਹੈ ਕਿੱਦਾਂ ਸਿਲਾਈ ਕਰੀਦੀ ਹੈ ਕਿੱਦਾਂ ਕਢਾਈ ਕਰੀਦੀ ਹੈ ਉਹ ਸਾਰਾ ਕੁਛ ਹੀ ਮੈਂ ਦੇਖਦੀ ਰਹਿੰਦੀ ਹਾਂ ਯੂਟੀਊਬ 'ਤੇ ਇਸ ਕਰਕੇ ਮੈਨੂੰ ਸਾਰੀ ਥੋੜ੍ਹੀ ਜਿਹੀ ਨੌਲੇਜ ਹੋਈ ਹੈ ਤਾਂ ਕਿ ਮੈਨੂੰ ਉਹ ਸੂਟ ਕੱਟਣ ਦੀ ਜਾਚ ਆਵੇ ਅਤੇ ਮੈਂ ਸਾਰਾ ਕੁਛ ਤਿਆਰ ਆਪਣੇ ਹੱਥਾਂ ਨਾਲ ਖੁਦ ਕਰ ਸਕਾਂ ਆਮ ਸੂਟ ਤਾਂ ਚਲੋ ਸਿਊ ਲੈਂਦਾ ਕਢਾਈ ਵੀ ਮੈਨੂੰ ਨਹੀਂ ਆਉਂਦੀ ਜ਼ਿਆਦਾਤਰ ਥੋੜ੍ਹੀ ਆਉਂਦੀ ਆ ਪਰ ਮੈਂ ਸਾਰਾ ਕੁਛ ਸਿੱਖਣਾ ਚਾਹੁੰਦੀ ਹਾਂ ਮੈਂ ਕੱਢਦੀ ਹਾਂ ਥੋੜ੍ਹਾ ਬਹੁਤਾ ਮੈਂ ਕਰ ਵੀ ਲੈਂਦੀ ਹਾਂ ਪਰ ਮੈਂ ਜ਼ਿਆਦਾ ਸਟੈਂਡ ਹੋਣਾ ਚਾਹੁੰਦੀ ਹਾਂ ਆਪਣੇ ਆਹ ਕੰਮ ਵਿੱਚ ਤਾਂ ਕਿ ਮੈਂ ਸਭ ਤੋਂ ਵਧੀਆ ਕੰਮ ਕਰਾਂ ਅਤੇ ਮੈਂ ਆਪਣਾ ਬੁਟੀਕ ਚਲਾ ਸਕਾਂ